ਸਤਿ ਸ਼੍ਰੀ ਅਕਾਲ ਅੱਜ ਮੈਂ ਇੱਕ ਵੈਬਸਾਈਟ ਬਿਲਡਰ ਦੀ ਵਰਤੋਂ ਕਰਕੇ ਆਪਣੀ ਵੈਬਸਾਈਟ ਬਣਾਉਣ ਦੀ ਯਾਤਰਾ ਨੂੰ ਸਾਂਝਾ ਕਰਨਾ ਚਾਹੁੰਦਾ ਹਾਂ ਇਹ ਇੱਕ ਦਿਲਚਸਪ ਤਜ਼ਰਬਾ ਸੀ ਜਿਸਨੇ ਮੈਨੂੰ ਡਿਜਾਇਨ ਕਾਰਜਸ਼ੀਲਤਾ ਅਤੇ ਸਮੱਸਿਆ ਹੱਲ ਕਰਨ ਬਾਰੇ ਬਹੁਤ ਕੁਝ ਸਿਖਾਇਆ ਮੇਰੀ ਯਾਤਰਾ ਦਾ ਪਹਿਲਾ ਕਦਮ ਸਹੀ ਵੈੱਬਸਾਈਟ ਬਿਲਡਰ ਦੀ ਚੋਣ ਕਰਨਾ ਸੀ ਇੱਥੇ ਬਹੁਤ ਸਾਰੇ ਵਿਕਲਪ ਉਪਲੱਬਧ ਸਨ ਉਹਨਾਂ ਦੀਆਂ ਵਿਸ਼ੇਸ਼ਤਾਵਾਂ ਦੀ ਖੋਜ ਕਰਨ ਤੋਂ ਬਾਅਦ ਮੈਂ ਇੱਕ ਵੈਬਸਾਈਟ ਬਿਲਡਰ ਦੀ ਚੋਣ ਕੀਤੀ ਵੈਬਸਾਈਟ ਬਿਲਡਰ ਦੀ ਚੋਣ ਕਰਨ ਤੋਂ ਬਾਅਦ ਪਹਿਲਾ ਕੰਮ ਸੀ ਸਹੀ ਟੈਂਪਲੇਟ ਦੀ ਚੋਣ ਕਰਨਾ ਵੈਬਸਾਈਟ ਬਿਲਡਰ ਪਹਿਲਾਂ ਤੋਂ ਹੀ ਡਿਜ਼ਾਇਨ ਕੀਤੇ ਟੈਂਪਲੇਟਾਂ ਦੀ ਪੇਸ਼ਕਸ਼ ਕਰਦੇ ਹਨ ਜਿਸ ਨਾਲ ਪੇਸ਼ੇਵਰ ਦਿੱਖ ਵਾਲੀ ਸਾਈਟ ਬਣਾਉਣਾ ਆਸਾਨ ਹੋ ਜਾਂਦਾ ਹੈ ਮੈਂ ਵੀ ਇੱਕ ਟੈਂਪਲੇਟ ਨੂੰ ਚੁਣਿਆ ਜੋ ਮੇਰੇ ਦ੍ਰਿਸ਼ਟੀਕੋਣ ਅਤੇ ਉਦੇਸ਼ ਨਾਲ ਮੇਲ ਖਾਂਦਾ ਸੀ ਫਿਰ ਮੈਂ ਫੋਂਟਾ ਰੰਗਾਂ ਅਤੇ ਲੇ ਆਊਟਾਂ ਨੂੰ ਵਿਅਕਤੀਗਤ ਬਣਾਉਣ ਲਈ ਡਰੈਕ ਐਂਡ ਡਰੋਪ ਸਟੂਲ ਦੀ ਪੜਚੋਲ ਕੀਤੀ ਵੱਖ ਵੱਖ ਡਿਜਾਇਨਾਂ ਨਾਲ ਪ੍ਰਯੋਗ ਕਰਨਾ ਮਜ਼ੇਦਾਰ ਰਿਹਾ ਇਸ ਤੋਂ ਬਾਅਦ ਵੈ ਵੈਬਸਾਈਟ ਬਿਲਡਰ ਮੁਫਤ ਅਤੇ ਕਸਟਮ ਡੋਮੇਨ ਦੀ ਪੇਸ਼ਕਸ਼ ਕਰਦੇ ਹਨ ਮੈਂ ਆਪਣੀ ਵੈਬਸਾਈਟ ਨੂੰ ਵਧੇਰੇ ਪੇਸ਼ੇਵਰ ਦਿਖਾਉਣ ਲਈ ਆਪਣੇ ਕਸਟਮ ਡੋਮੇਨ ਨੂੰ ਕਿਵੇਂ ਜੋੜਨਾ ਹੈ ਉਸ ਤੋਂ ਸਿੱਖ ਲਿਆ ਮੈਨੂੰ ਅਹਿਸਾਸ ਹੋਇਆ ਬਹੁਤ ਸਾਰੇ ਵਿਸਟਰ ਆਪਣੇ ਫੋਨਾਂ ਉੱਤੇ ਵੈਬਸਾਈਟਾਂ ਨੂੰ ਬਰਾਊਜ ਕਰਦੇ ਹਨ ਇਸ ਲਈ ਮੈਨੂੰ ਇਹ ਯਕੀਨੀ ਬਣਾਉਣਾ ਪਿਆ ਕਿ ਮੇਰੀ ਸਾਈਟ ਸਾਰੇ ਡਿਵਾਈਸਾਂ ਉੱਤੇ ਵਧੀਆ ਦਿਖਾਈ ਦੇਣੀ ਚਾਹੀਦੀ ਹੈ ਵੈਬਸਾਈਟ ਬਣਾਉਂਦੇ ਸਮੇਂ ਮੈਨੂੰ ਬਹੁਤ ਸਾਰੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਇੱਜ਼ਤ ਮੈਂ ਬਹੁਤ ਕੁਝ ਸਿੱਖਿਆ ਵੀ